ਭੰਗੜੇ ਪੰਜਾਬ ਵਿੱਚ ਬਹੁਤ ਤਰ੍ਹਾਂ ਦੇ ਹੁੰਦੇ ਆ ਬਹੁਤ ਸਟੈਪ ਨੇ ਬਹੁਤ ਜਿਆਦਾ ਪੰਜਾਬੀ ਭੰਗੜਾ ਫੁਲਕਾ ਭੰਗੜਾ ਝੂਮਰ ਭੰਗੜਾ ਚੰਡੀ ਭੰਗੜਾ ਜੰਬਲ ਸਿੰਘਾ ਭੰਗੜਾ ਲਹਿਰੀਆਂ ਮੋਰ ਚਾਲ ਘੋੜਾ ਜਾਲ ਪਹਿਲਾਂ ਬਹੁਤ ਤਰ੍ਹਾਂ ਦੇ ਭੰਗੜੇ ਨੇ ਜਿਵੇਂ ਜਿਵੇਂ ਤੁਸੀਂ ਅੱਗੇ ਅੱਗੇ ਜਾਈ ਜਾਓਗੇ ਜਿਨਾਂ ਦੀ ਮੈਨੂੰ ਨੋਲੇਜ ਹੈ ਮੈਂ ਉਸ ਹਿਸਾਬ ਨਾਲ ਮੈਂ ਤੁਹਾਨੂੰ ਦੇ ਰਹੀ ਆਂ ਬਾਕੀ ਬੱਚੇ ਸਾਰੇ ਅੱਜ ਕੱਲ ਜਾਣਦੇ ਹੈਗੇ ਨੇ ਮੈਨੂੰ ਤਾਂ ਇੰਨਾ ਹੀ ਤਾ ਪਤਾ ਸੀਗਾ ਬਾਕੀ ਮੈਂ ਇਸ ਤੋਂ ਬਾਅਦ ਹੋਰ ਕੋਸ਼ਿਸ਼ ਕਰਦੀ ਆਂ ਵੀ ਵੱਧ ਤੋਂ ਵੱਧ ਜਿਵੇਂ ਦਾ ਆਇਆ ਉਵੇਂ ਦਾ ਨੱਚ ਲਿਆ ਖੁਸ਼ੀ ਮਨਾ ਲਈ ਤੇ ਆਪਣਾ ਆਪਣਾ ਟੈਂਸ਼ਨ ਫਰੀ ਹੋ ਲਿਆ ਟੈਂਸ਼ਨ ਨਹੀਂ ਹੋਏਗੀ ਤੇ ਵਧੀਆ ਰਹਾਂਗੇ ਭੰਗੜੇ ਨਾਲ ਬੰਦਾ ਖੁਸ਼ ਰਹਿੰਦਾ ਤੇ ਨਾਲ ਫਰੈਸ਼ ਰਹਿੰਦਾ